ਹਾਂ ਮੇਰੀ ਰਾਏ ਵਿੱਚ ਪੇਂਡੂ ਭਾਈਚਾਰਿਆਂ ਵਿੱਚ ਖੇਤੀਬਾੜੀ ਉਦਯੋਗ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਬਹੁਤ ਕੁਝ ਕੀਤਾ ਜਾ ਸਕਦਾ ਹੈ ਜਿਵੇਂ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ ਖੇਤੀਬਾੜੀ ਵਿੱਚ ਬਜ ਵਪਾਰੀ ਵਪਾਰਕ ਚੀਜ਼ਾਂ ਜਿਹੜੀਆਂ ਉਹਨਾਂ ਦੀ ਖੇਤੀ ਕੀਤੀ ਜਾ ਸਕਦੀ ਹੈ ਜਿਵੇਂ ਕਿ ਪਰਸਨ ਵਾਸਤੇ ਸਣ ਵਗੈਰਾ ਬੀਜਿਆ ਜਾ ਸਕਦੇ ਆ ਬੀਜੀ ਜਾ ਸਕਦੀ ਹੈ ਸਬਜ਼ੀਆਂ ਦੀ ਨਵੀਂ ਤਕਨੀਕ ਅਨੁਸਾਰ ਸਬਜ਼ੀਆਂ ਪੈਦਾ ਕਰਕੇ ਅਤੇ ਅਸੀਂ ਮੰਡੀ ਦੇ ਵਿੱਚ ਜਿਹੜਾ ਮੁਨਾਫਾ ਕਮਾ ਸਕਦੇ ਹਾਂ ਫਿਰ ਖੇਤੀਬਾੜੀ ਦੀ ਦੇ ਨਾਲ ਜਿਹੜੀ ਜਿੱਦਾਂ ਪੇਂਡੂ ਦਸਤਕਾਰੀ ਟੋਕਰੀਆਂ ਵਗੈਰਾ ਬਣਾ ਕੇ ਉਹ ਉਹ ਵੀ ਕੰਮ ਕੀਤਾ ਜਾ ਸਕਦਾ ਹੈ ਫਿਰ ਸ਼ਹਿਦ ਵਗੈਰਾ ਜਿਹੜਾ ਉਹ ਉਹਦਾ ਉਦਯੋਗ ਕੀਤਾ ਜਾ ਸਕਦਾ ਹੈ ਫਿਰ ਰੇਸ਼ਮ ਦਾ ਉਦਯੋਗ ਜਿਹੜਾ ਉਹ ਲਾ ਸਕਦੇ ਹਾਂ ਫਿਰ ਕਿਸਾਨਾਂ ਨੂੰ ਰੇਸ਼ਮ ਦੇ ਕੀੜੇ ਪਾਲਣ ਵਾਸਤੇ ਕਿਹਾ ਸੀ ਕਿਹਾ ਜਾ ਸਕਦਾ ਹੈ ਅਤੇ ਇਸ ਇਸ ਤੋਂ ਇਲਾਵਾ ਇੱਕ ਨਾ ਮੁਰਗੀਖਾਨੇ ਦਾ ਕੰਮ ਵੀ ਜਿਹੜਾ ਉਹ ਪਿੰਡਾਂ ਦੇ ਵਿੱਚ ਜਿਹੜਾ ਇਹ ਉਦਯੋਗ ਚਲਾਇਆ ਜਾ ਸਕਦਾ ਹੈ ਖੁੰਬਾਂ ਦੀ ਖੇਤੀ ਕੀਤੀ ਜਾ ਸਕਦੀ ਹੈ